ਹੈਲੋ ਹੈਲੋ ਸਤਿ ਸ਼੍ਰੀ ਅਕਾਲ ਭਾਅ ਜੀ ਤੁਸੀਂ ਅਰਸ਼ਦੀਪ ਸਿੰਘ ਬੋਲਦੇ ਹੋ ਗੁਰੂ ਨਾਨਕ ਦੇਵ ਸ ਸਟੂਡੀਓ ਤੋਂ ਹਾਂਜੀ ਅਤੇ ਉਹ ਮੈਂ ਮੇਰੇ ਨਾ ਦੋਸਤ ਨੇ ਦੱਸਿਆ ਸੀਗਾ ਤੁਹਾਡੇ ਬਾਰੇ ਕਿ ਤੁਸੀਂ ਫੋਟੋਗ੍ਰਾਫੀ ਬੜੀ ਵਧੀਆ ਕਰਦੇ ਜੇ ਹਾਂਜੀ ਅਤੇ ਮੇਰੇ ਭਰਾ ਦਾ ਨਾ ਵਿਆਹ ਸੀਗਾ ਪੰਜ ਮਾਰਚ ਨੂੰ ਅਤੇ ਤੁਸੀਂ ਉਦੋਂ ਆ ਜਾਓਗੇ ਫਰੀ ਹੋ ਹਾਂਜੀ ਅਤੇ ਮੈਨੂੰ ਮੈਂ ਤੁਹਾਨੂੰ ਆਪਣਾ ਐਡਰੈਸ ਦੱਸ ਦੂੰਗਾ ਅਤੇ ਤੁਸੀਂ ਕਿੰਨੀ ਹਾਂਜੀ ਪੰਜ ਮਾਰਚ ਹਾਂਜੀ ਅਤੇ ਤੁਸੀਂ ਮੈਨੂੰ ਦੱਸ ਦਿਓ ਕਿੰਨੇ ਪੈਸੇ ਲਓਗੇ ਪ੍ਰੋਗਰਾਮ ਦਿਨ ਦਾ ਆ ਹਾਂਜੀ ਹਾਂਜੀ ਜਾਗੋ ਵੀ ਸਾਰੇ ਫੰਕਸ਼ਨ ਹੈਗੇ ਆ

ਹਾਂਜੀ ਹਾਂਜੀ ਠੀਕ ਆ ਅਤੇ ਮੈਂ ਤਾਂ ਤੁਹਾਨੂੰ ਐਡਵਾਂਸ ਪੇਮੈਂਟ ਕਰ ਦਿੰਦਾ ਹਾਂ ਕੱਲ੍ਹ ਕਰ ਦੂੰਗਾ ਐਡਵਾਂਸ ਹਾਂਜੀ ਚਲੋ ਠੀਕ ਆ ਥੈਂਕ ਯੂ ਹਾਂਜੀ ਓਕੇ